ਕਾਰਬਨ ਫੁੱਟ ਪ੍ਰੀਟਿੰਗ ਦਾ ਮਤਲਬ ਇਹ ਹੈ ਕਿ ਜੋ ਵੀ ਆਪਾਂ ਸਮਾਨ ਘਰ ਵਿੱਚ ਯੂਜ ਕਰਦੇ ਹਨ ਜਿਹਦੇ ਵਿੱਚੋਂ ਕਾਰਬਨ ਡਾਇਓਅਕਸਾਈਡ ਜਾਂ ਕਲੋਰੋਫਲੋਰੋਕਾਰਬਨ ਨਿਕਲਦੀ ਹੈ ਜੋ ਕਿ ਸਾਡੇ ਵਾਤਾਵਰਨ ਵਾਸਤੇ ਬਿਲਕੁਲ ਵੀ ਸਹੀ ਨਹੀਂ ਹੈ ਉਸ ਦੀ ਜਾਂਚ ਕਰਨਾ ਜਦੋਂ ਵੀ ਆਪਾਂ ਘਰ ਬਣਾਉਂਦੇ ਹਨ ਤਾਂ ਆਪਾਂ ਉਸ ਵਿੱਚ ਆਪਣੀ ਸਹਾਇਤਾ ਵਾਸਤੇ ਫਰਿੱਜ ਏ ਸੀ ਇਹ ਸਭ ਲਗਾਉਂਦੇ ਹਾਂ ਜੋ ਕਿ ਬਹੁਤ ਹੀ ਬੇਕਾਰ ਗੈਸਾਂ ਛੱਡਦੇ ਹਨ ਜੋ ਕਿ ਵਾਤਾਵਰਨ ਵਾਸਤੇ ਬਹੁਤ ਜ਼ਿਆਦਾ ਜ਼ਹਿਰੀਲੀਆਂ ਹੁੰਦੀਆਂ ਹਨ ਅਤੇ ਮੈਂ ਆਪਣਾ ਨਵਾਂ ਘਰ ਬਣਾਇਆ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਇਹਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਾਂ ਇਸ ਲੀਏ ਮੈਂ ਆਪਣਾ ਫਰਿਜ ਤਾਂ ਬਦਲੇ ਫਰਿੱਜ ਨੂੰ ਤਾਂ ਮੈਂ ਘੱਟ ਨਹੀਂ ਕਰ ਸਕਦੀ ਪਰ ਮੈਂ ਇਹ ਜ਼ਰੂਰ ਕਰ ਸਕਦੀ ਹਾਂ ਕਿ ਉਸ ਦੀ ਵਰਤੋਂ ਬਹੁਤ ਘੱਟ ਤੋਂ ਘੱਟ ਕਰਾਂ ਜਦੋਂ ਸਾਨੂੰ ਫਰਿੱਜ ਦੀ ਲੋੜ ਹੋਵੇ ਜ਼ਿਆਦਾਤਰ ਫਰਿੱਜ ਦੀ ਲੋੜ ਗਰਮੀਆਂ 'ਚ ਹੀ ਪੈਂਦੀ ਹੈ ਅਤੇ ਮਤਲਬ ਜ਼ਿਆਦਾ ਤੋਂ ਜ਼ਿਆਦਾ ਆਪਾਂ ਉਹਨੂੰ ਗਰਮੀਆਂ 'ਤੇ ਹੀ ਯੂਜ ਕਰੀਏ ਏ ਸੀ ਏ ਸੀ ਵੀ ਲੋਕ ਗਰਮੀਆਂ 'ਚ ਯੂਜ ਕਰਦੇ ਹਨ ਗਰਮੀਆਂ ਤੋਂ ਬਚਣ ਵਾਸਤੇ ਯੂਜ ਕਰਦੇ ਹਨ ਅਤੇ ਮੈਂ ਇਹ ਚਾਹੁੰਦੀ ਹਾਂ ਕਿ ਮੈਂ ਏ ਸੀ ਦੇ ਬਦਲੇ ਆਪਾਂ ਪੱਖੇ ਪੱਖਿਆਂ ਦੇ ਹੀ ਯੂਜ ਕਰੀਏ ਕਿਉਂਕਿ ਪੱਖੇ ਕਦੇ ਵੀ ਕੋਈ ਵੀ ਜ਼ਹਿਰੀਲੀ ਗੈਸ ਨਹੀਂ ਛੱਡਦੇ ਹਨ ਜ਼ਹਿਰੀਲੀ ਗੈਸ ਛੱਡਣ ਦੇ ਕਾਰਨ ਏ ਸੀ ਸਾਡੇ ਵਾਤਾਵਰਨ ਨੂੰ ਬਹੁਤ ਜ਼ਿਆਦਾ ਖਰਾਬ ਕਰ ਰਿਹਾ ਹੈ ਲੋਕਾਂ ਨੂੰ ਸਾਹ ਲੈਣ 'ਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਪਈਆਂ ਹਨ ਜਿਸ ਕਾਰਨ ਮੈਂ ਇਹ ਸੋਚਿਆ ਹੈ ਕਿ ਮੈਂ ਏ ਸੀ ਫਰਿੱਜ ਇਹਨਾਂ ਸਭ ਦੀ ਘੱਟ ਤੋਂ ਘੱਟ ਵਰਤੋਂ ਕਰਾਂਗੀ